ਤੀਹ ਮਾਰਚ ਉੱਨੀ ਸੌ ਨੱਬੇ ਅਠਾਈ ਨਵੰਬਰ ਦੋ ਹਜ਼ਾਰ ਪੰਦਰਾਂ ਪੰਦਰਾਂ ਜੁਲਾਈ ਦੋ ਹਜ਼ਾਰ ਸੋਲਾਂ ਨੌਂ ਮਈ ਉੱਨੀ ਸੌ ਸਤਾਸੀ ਛੱਬੀ ਜਨਵਰੀ ਉੱਨੀ ਸੌ ਅ ਅਠਾਹਠ